ਜਿਵੇਂ ਕਿ ਦੱਸਿਆ ਗਿਆ ਹੈ ਕਿ ਹਰ ਇੱਕ ਸਟੇਟ ਹਰ ਇੱਕ ਦੇਸ਼ ਦੀ ਭੋਜਨ ਬਣਾਉਣ ਦੀ ਆਪਣੀ ਪ੍ਰਕਿਰਿਆ ਹੁੰਦੀ ਹੈ ਕਿ ਉਹ ਕਿੱਦਾਂ ਭੋਜਨ ਬਣਾਉਂਦੇ ਨੇ ਪਕਾਉਂਦੇ ਨੇ ਅਤੇ ਕੀਦੇ ਨਾਲ ਭੋਜਨ ਖਾਣਾ ਪਸੰਦ ਕਰਦੇ ਨੇ ਜਿਵੇਂ ਕਿ ਦੱਖਣੀ ਭਾਰਤ ਦੇ ਖਾਣੇ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਇਡਲੀ ਡੋਸਾ ਰਾਈਸ ਸਾਂਬਰ ਫਿਸ਼ ਰਾਈਸ ਵੜ੍ਹਾ ਪਾਓ ਉਤਪਮ ਆਦਿ ਭੋਜਨ ਬਣਾਉਣੇ ਲੋਕ ਪਸੰਦ ਕਰਦੇ ਨੇ ਅਤੇ ਖਾਂਦੇ ਹਨ ਅਤੇ ਇਹ ਉਹਨਾਂ ਦੇ ਉੱਥੋਂ ਦੇ ਟ੍ਰਡੀਸ਼ਨਲ ਭੋਜਨ ਅਤੇ ਮੈਨੂੰ ਵੀ ਇਹ ਬਹੁਤ ਪਸੰਦ ਨੇ ਮੈਂ ਵੀ ਇਹਨਾਂ ਨੂੰ ਬਣਾਉਣਾ ਅਤੇ ਖਾਣਾ ਬਹੁਤ ਪਸੰਦ ਕਰਦੀ ਹਾਂ ਜਿਵੇਂ ਐਗਜਾਮਪਲ ਦੇ ਤੌਰ 'ਤੇ ਪੰਜਾਬ ਹੈ ਪੰਜਾਬ ਦੇ ਵਿੱਚ ਦਾਲ ਸਾਗ ਮੱਕੀ ਦੀ ਰੋਟੀ ਅਤੇ ਇੱਥੋਂ ਦੇ ਲੋਕ ਮਸਾਲੇਦਾਰ ਸਬਜ਼ੀਆਂ ਛੋਲੇ ਭਟੂਰੇ ਕੁਲਚੇ ਆਦਿ ਖਾਣਾ ਪਸੰਦ ਕਰਦੇ ਨੇ ਇਹ ਇੱਥੋਂ ਦੀਆਂ ਮਸ਼ਹੂਰ ਡਿਸੀਜ਼ ਨੇ ਇਸ ਤਰ੍ਹਾਂ ਜੋ ਉਹ ਵੜ੍ਹਾ ਪਾਓ ਫਿਸ਼ ਰਾਈਸ ਡੋਸਾ ਸਾਂਬਰ ਇਹ ਸਾਊਥ ਦੀਆਂ ਮਨਪਸੰਦ ਡਿਸੀਜ਼ ਨੇ ਅਤੇ ਇਹਨਾਂ ਡਿਸੀਜ਼ ਨੂੰ ਮੈਂ ਵੀ ਬਹੁਤ ਪਸੰਦ ਕਰਦੀ ਹਾਂ ਅਤੇ ਮੈਨੂੰ ਇਹ ਬਣਾਉਣੀਆ ਅਤੇ ਖਾਣੀਆਂ ਬਹੁਤ ਹੀ ਚੰਗੀਆਂ ਲੱਗਦੀਆਂ ਹਨ ਅਤੇ ਹੁਣ ਜੇ ਅਸੀਂ ਗੱਲ ਕਰੀਏ ਨੌਰਥ ਨੌਰਥ ਦੇ ਭੋਜਨ ਦੀ ਤਾਂ ਨੌਰਥ ਦੇ ਵਿੱਚ ਦਾਲ ਮੱਖਣੀ ਚਿੱਲੀ ਚਿਕਨ ਛੋਲੇ ਭਟੂਰੇ ਕੜ੍ਹੀ ਚਾਵਲ ਪਰੌਂਠੇ ਕੜ੍ਹਾਹੀ ਪਨੀਰ ਬਟਰ ਚਿਕਨ ਇਹੋ ਜਿਹੀਆਂ ਕਾਫ਼ੀ ਡਿਸੀਜ਼ ਨੇ ਜੋ ਉੱਥੋਂ ਦੀਆਂ ਬਹੁਤ ਹੀ ਫੇਮਸ ਡਿਸੀਜ਼ ਨੇ ਲੋਕ ਉਹਨਾਂ ਨੂੰ ਬਣਾਉਣਾ ਅਤੇ ਖਾਣਾ ਪਸੰਦ ਕਰਦੇ ਹਾਂ ਔਰ ਮੈਂ ਖੁਦ ਵੀ ਇਹਨਾਂ ਡਿਸੀਜ਼ ਨੂੰ ਘਰ ਵਿੱਚ ਖਾਣਾ ਬਣਾਉਣਾ ਪਸੰਦ ਕਰਦੀ ਹਾਂ ਕਿਉਂਕਿ ਇਹ ਮੇਰੀਆਂ ਵੀ ਬਹੁਤ ਹੀ ਮਨਪਸੰਦ ਡਿਸੀਜ਼ ਨੇ ਅਤੇ ਹ ਹਰ ਇੱਕ ਸਟੇਟ ਆਪਣੇ ਆਪ ਵਿੱਚ ਖਾਣਾ ਬਣਾਉਣ ਖਾਣਾ ਖਾਣਾ ਖਾਣ ਪਸੰਦ ਕਰਦੀ ਹੈ ਫਿਰ ਵੀ ਅਸੀਂ ਕੁਝ ਭੋਜਨ ਅਜਿਹੇ ਹੁੰਦੇ ਨੇ ਜੋ ਸਾਨੂੰ ਪਸੰਦ ਆਉਂਦੇ ਨੇ ਹੁਣ ਤਾਂ ਪੰਜਾਬ ਵਿੱਚ ਵੀ ਨੌਰਥ ਅਤੇ ਸਾਊਥ ਦੀਆਂ ਕੁਝ ਅਜਿਹੀਆਂ ਡਿਸੀਜ਼ ਨੇ ਜਿੰਨ੍ਹਾਂ ਨੂੰ ਲੋਕ ਖਾਣਾ ਪਸੰਦ ਕਰਦੇ ਨੇ ਅਤੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਮੈਂ ਖੁਦ ਉਹਨਾਂ ਡਿਸੀਜ਼ ਨੂੰ ਖਾਣਾ ਅਤੇ ਬਣਾਉਣਾ ਪਸੰਦ ਕਰਦੀ ਆ ਧੰਨਵਾਦ